ਪੰਜਾਬੀ ਭਾਸ਼ਾ ਨੂੰ ਸੁਰੱਖਿਅਤ ਰੱਖਣ ਵਾਸਤੇ ਸਰਕਾਰ ਵੱਲੋਂ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਅੱਗੇ ਵੀ ਇਸ ਦੇ ਉਪਰਾਲੇ ਕੀਤੇ ਜਾਣਗੇ ਇਸ ਵਿੱਚ ਬਹੁਤ ਹੀ ਸਾਨੂੰ ਸੱਭਿਅਤਾ ਕਿਤਾਬਾਂ ਰਸਾਲੇ ਪੜ੍ਹਨ ਨੂੰ ਮਿਲਦੇ ਹਨ ਨਵੇਂ ਨਵੇਂ ਪ੍ਰੋਗਰਾਮ ਇਸ ਵਿੱਚ ਸ਼ਾਮਿਲ ਹੋ ਰਹੇ ਹਨ ਜਿਸ ਵਿੱਚ ਸਕੂਲ ਕਾਲਜ ਪ੍ਰੋਪਰ ਹਿੱਸਾ ਲੈ ਰਹੇ ਹਨ ਬੱਚੋ ਵੀ ਵਧ ਚੜ੍ਹ ਕੇ ਇਸ ਵਿੱਚ ਹਿੱਸਾ ਪ੍ਰਾਪਤ ਕਰਦੇ ਹਨ ਅਧਿਆਪਕ ਉਨ੍ਹਾਂ ਦਾ ਸਾਥ ਦਿੰਦੇ ਹਨ ਸਾਡੀ ਜਿਹੜੀ ਸੱਭਿਅਤਾ ਪੰਜਾਬੀ ਚੱਲੀ ਆ ਰਹੀ ਹੈ ਉਹ ਇਹਦਾ ਮੁੱਖ ਮੂਲ ਹੈ ਸਾਡੇ ਜਿਹੜੇ ਕਵਿਸ਼ਰੀ ਸੀ ਜਾਂ ਸੰਗੀਤਕਾਰ ਸੀ ਉਨ੍ਹਾਂ ਨੇ ਵੀ ਪੰਜਾਬੀ ਨੂੰ ਵਧਾਉਣ ਵਾਸਤੇ ਬਹੁਤ ਹੀ ਜ਼ਿਆਦਾ ਸੰਜੋ ਦਿੱਤਾ